ਪੰਜਾਬ ਸਥਾਨਕ ਕਾਰੋਬਾਰ ਆਪਣੇ ਆਪਣੇ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਅਤੇ ਮਾਰਕੀਟ ਦੇ ਵਿੱਚ ਇਹ ਆਪ ਸਥਾਨਕ ਕਾਰੋਬਾਰਾਂ ਦੇ ਵਿੱਚ ਬਹੁਤ ਮੁਕਾਬਲਾ ਦੇਖਿਆ ਜਾਂਦਾ ਹਰੇਕ ਕੋਈ ਆਪਣਾ ਆਪਣੇ ਕਾਰੋਬਾਰ ਦੀ ਕੁਆਲਿਟੀਆਂ ਅਤੇ ਪ੍ਰੋਜੀਬਿਲਟੀ ਨੂੰ ਮੁੱਖ ਰੱਖ ਕੇ ਸਾਰਾ ਕੰਮ ਕਰਦਾ ਹੈ ਅਤੇ ਕੋਈ ਡਿਸਕਾਊਂਟ ਵਗੈਰਾ ਲੈਂਦਾ ਹੈ ਕੋਈ ਸੇਲ ਵਗੈਰਾ ਲੈਂਦਾ ਜਿਸ ਹਿਸਾਬ ਨਾਲ ਉਹਨਾਂ ਦਾ ਆਪਣਾ ਆਪਣਾ ਕਾਰੋਬਾਰ ਸਹੀ ਤਰੀਕੇ ਦੇ ਨਾਲ ਚੱਲਦਾ ਰਹਿੰਦਾ